ਕੁਝ ਮਹਾਨ ਆਗੂ ਜਾਂ ਰਾਜੇ ਜਿਹਨਾਂ ਤੋਂ ਮੈਂ ਆਪਣੇ ਦਾਦਾ ਜੀ ਤੋਂ ਸੁਣਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅੰਗਰੇਜ਼ ਵੀ ਨੌਕਰੀ ਕਰਨ ਆਇਆ ਕਰਦੇ ਸੀ ਅਤੇ ਉਹਨਾਂ ਦੇ ਤੁਹਾਡੇ ਖੇਤਰ ਦਾ ਜਿਹੜਾ ਇਤਿਹਾਸ ਸਾਡੇ ਯੋਗਦਾਨ ਦੇ ਵਿੱਚ ਜਿਹੜਾ ਪਾਇਆ ਜਾਂਦਾ ਹੈ ਉਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹੜੇ ਦੁਨੀਆਂ ਦੇ ਸ਼੍ਰਿਸ਼ਟੀ ਹਨ ਜਿਹਨਾਂ 'ਤੇ ਦੁਨੀਆਂ ਸੀਸ ਝੁਕਾਉਂਦੀ ਹੈ ਜਿਹਨਾਂ ਨੂੰ ਦੁਨੀਆਂ ਜਾਣਦੀ ਹੈ ਜਿਹਨਾਂ ਦੀ ਬਾਣੀ ਪੜ੍ਹਦੇ ਨੇ ਅਤੇ ਉਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਡੇ ਆਗੂ ਹਨ ਅਤੇ ਦੁਨੀਆਂ ਨਮਸਕਾਰ ਕਰਦੀ ਹੈ ਅਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਚੱਲਦੀ ਹੈ